ਉੱਨੀ ਅਕਤੂਬਰ ਉੱਨੀ ਸੌ ਬਿਆਸੀ ਦੋ ਮਾਰਚ ਦੋ ਹਜ਼ਾਰ ਚਾਰ ਛੇ ਅਪ੍ਰੈਲ ਦੋ ਹਜ਼ਾਰ ਤਿੰਨ ਸਤੰਬਰ ਉੱਨੀ ਸੌ ਨੜਿਨਵੇਂ ਛੇ ਅਕਤੂਬਰ ਦੋ ਹਜ਼ਾਰ ਪੰਜ